ਮੇਰੀ ਜ਼ਿੰਦਗੀ ਦਾ ਸਭ ਤੋਂ ਮਹੱਤਵ ਫੈਸਲਾ ਉਹ ਸੀ ਜਦੋਂ ਮੈਂ ਆਪਣੀ ਛੋਟੀ ਭੈਣ ਨੂੰ ਬਾਹਰ ਪੜ੍ਹਨ ਲਈ ਭੇਜਣਾ ਸੀ ਕਿਉਂਕਿ ਅੱਜ ਕੱਲ੍ਹ ਬਾਹਰ ਦਾ ਮਾਹੌਲ ਬਹੁਤ ਹੀ ਖਰਾਬ ਹੈ ਇਸ ਲਈ ਮੈਂ ਇਸ ਉਸ ਸਮੇਂ ਬਹੁਤ ਹੀ ਉਲਝਿਆ ਹੋਇਆ ਸੀ ਵੀ ਭੇਜਾਂ ਨਾ ਭੇਜਾਂ ਫਿਰ ਮੈਂ ਆਪਣੇ ਮਨ ਨੂੰ ਸੋਚਿਆ ਮਨ ਨੂੰ ਸਮਝਾਇਆ ਸ਼ਾਂਤਮਈ ਤਰ ਤਰੀਕੇ ਨਾਲ਼ ਬੈਠਿਆ ਸੋਚਿਆ ਉਸ ਬਾਰੇ ਫੈਸਲਾ ਲਿਆ ਥੋੜ੍ਹਾ ਜਿਹਾ ਮੈਂ ਫ ਫਿਰ ਕਨ ਵੀ ਮੁਸ਼ਕਿਲਾਂ ਵਿੱਚ ਪੈ ਗਿਆ ਸੀ ਕਿ ਪੈਸੇ ਬਹੁਤ ਲੱਗ ਜਾਣੇ ਕਿਵੇਂ ਭੇਜੀਏ ਕਿਵੇਂ ਰਹੇਗੀ ਉੱਥੇ ਉਹ ਇਸ ਲਈ ਮੈਂ ਬਹੁਤ ਹੀ ਟੈਨਸ਼ਨ ਵਿੱਚ ਸੀ ਇਸ ਦੇ ਲਈ ਮੈਂ ਆਪਣੇ ਮੰਮੀ ਡੈਡੀ ਤੋਂ ਸਲਾਹ ਲਈ ਉਨ੍ਹਾਂ ਨੂੰ ਪੁੱਛਿਆ ਵੀ ਆਪਾਂ ਪੈਸੇ ਦਾ ਕਿੱਦਾ ਕਰਾਂਗੇ ਭੇਜ ਦੇਈਏ ਉਨ੍ਹਾਂ ਨੇ ਫਿਰ ਮੈਨੂੰ ਦੱਸਿਆ ਕਿ ਕੋਈ ਗੱਲ ਨਹੀਂ ਦੁਨੀਆਂ ਜਾਂਦੀ ਹੈ ਆਪਾਂ ਵੀ ਭੇਜ ਦਿੰਦੇ ਹੈ ਇਸ ਦਾ ਕੋਰਸ ਵਧੀਆ ਹੈ ਇੱਥੇ ਇਹਨੂੰ ਸ ਉੱਥੇ ਸੌਖਾ ਹੋਊਗਾ ਅਤੇ ਉੱਥੇ ਉਹਨੂੰ ਲੇ ਰਹਿਣ ਲਈ ਵੀ ਜਗ੍ਹਾ ਮਿਲ ਜਾਣੀ ਹੈ ਇਸ ਲਈ ਮੈਂ ਬੇਫਿਕਰ ਹੋ ਕੇ ਉਸ ਨੂੰ ਕਨੇਡਾ ਭੇਜ ਦਿੱਤਾ